ਸਿੱਖਿਆ ਰੁਜ਼ਗਾਰ ਦੇ ਰੂਪ 'ਚ ਪਟਿਆਲਾ ਜ਼ਿਲ੍ਹੇ ਸਾਹਮਣੇ ਕਾਫੀ ਚੁਣੌਤੀਆਂ ਆਉਂਦੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਮੇਨ ਚੁਣੌਤੀ ਹੈਗੀ ਆ ਕਿ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਉਹਦੇ ਉੱਤੇ ਮਾਪਿਆਂ ਦਾ ਪ੍ਰੈਸ਼ਰ ਬਹੁਤ ਹੀ ਜ਼ਿਆਦਾ ਕਿਉਂਕਿ ਉਹਨਾਂ ਦਾ ਇੰਟਰਸਟ ਕਿਸੇ ਹੋਰ ਸਬਜੈਕਟ ਦੇ ਵਿੱਚ ਹੁੰਦਾ ਪਰ ਜਿਹੜੇ ਉਹਨਾਂ ਦੇ ਮਾਪੇ ਨੇ ਉਹ ਥੋੜ੍ਹਾ ਆਪਣੇ ਇੰਟਰਸਟ ਦੇ ਹਿਸਾਬ ਨਾਲ ਉਹਨਾਂ ਨੂੰ ਵਿਸ਼ਿਆਂ ਦੀ ਚੋਣ ਕਰਵਾਉਂਦੇ ਨੇ ਜਿਵੇਂ ਕਿ ਕਈ ਬੱਚਿਆਂ ਦਾ ਪੇਂਟਿੰਗ ਦੇ ਵਿੱਚ ਸਿੰਗਿੰਗ ਦੇ ਵਿੱਚ ਦਿਲਚਸਪੀ ਜ਼ਿਆਦਾ ਹੁੰਦੀ ਆ ਪਰ ਉਹਨਾਂ ਦੇ ਮਾਪੇ ਕਿਸੇ ਦੂਸਰੇ ਬੱਚੇ ਦੀ ਰੀਸ ਦੇ ਨਾਲ ਕਹਿੰਦੇ ਆ ਕਿ ਸਾਇੰਸ ਦੇ ਵਿਸ਼ੇ ਚੁਣ ਲਏ ਜਾਣ ਤੇਰੇ ਵੱਲੋਂ ਵੀ ਪਰ ਬੱਚੇ ਦੇ ਇੰਟਰਸਟ ਨਾ ਹੋਣ ਕਰਕੇ ਉਹ ਇੰਨਾ ਵਧੀਆ ਉਹਦੇ ਵਿੱਚ ਪਰਫੋਰਮ ਨਹੀਂ ਕਰ ਪਾਉਂਦਾ ਅਤੇ ਉਹਦੇ ਵਿੱਚੋਂ ਉਹਦੇ ਮਾਕਸ ਅਲਟੀਮੇਟਲੀ ਘੱਟ ਜਾਂਦੇ ਆ ਜਦੋਂ ਵਿਸ਼ੇ ਸਹੀ ਨਹੀਂ ਚੁਣੇ ਤਾਂ ਸਿੱਧੀ ਜਿਹੀ ਗੱਲ ਹੈਗੀ ਆ ਕਿ ਉਹਨੂੰ ਰੁਜ਼ਗਾਰ ਦੇ ਜਿਹੜੇ ਮੌਕੇ ਨੇ ਉਹ ਵੀ ਘੱਟ ਮਿਲਣਗੇ ਜਾਂ ਉਹਨਾਂ ਵਿੱਚੋਂ ਉਹ ਵਧੀਆ ਆਪਣਾ ਪਰਫੋਰਮ ਨਹੀਂ ਕਰ ਪਾਏਗਾ ਇਸ ਕਰਕੇ ਇਹ ਚੁਣੌਤੀਆਂ ਕਾਫੀ ਅੱਜ ਦੀ ਪੀੜ੍ਹੀ ਵਿੱਚ ਪਾਈਆਂ ਜਾ ਰਹੀਆਂ ਨੇ ਦੂਸਰਾ ਹੈਗਾ ਜੇ ਕੋਈ ਸਿੰਗਲ ਪੇਰੈਂਟ ਹੈਗਾ ਤਾਂ ਉਹ ਇੱਕ ਤਾਂ ਅਮ ਅ ਕਿਸੇ ਦਾ ਮਤਲਬ ਮਾਤਾ ਹੈਗੇ ਨੇ ਪਿਤਾ ਦੀ ਸਪੋਜ਼ ਕਰੋ ਕਿ ਰੱਬ ਨਾ ਕਰੇ ਕਿਸੇ ਹਾਦਸੇ ਵਿੱਚ ਡੈੱਥ ਹੋ ਗਈ ਤਾਂ ਉਹਦੇ ਨਾਲ ਕੀ ਹੁੰਦਾ ਵੀ ਉਹਦੇ ਮਾਤਾ ਇੰਨੀ ਇਨਕਮ ਨਹੀਂ ਹੁੰਦੀ ਉਹਦੇ ਕੋਲ ਇੰਨੀ ਕਿ ਉਹ ਉਹਨੂੰ ਕਿਸੇ ਵਧੀਆ ਅਦਾਰੇ ਤੋਂ ਵਿਦਿਆ ਦਵਾ ਸਕੇ ਅਤੇ ਉਸ ਤੋਂ ਬਾਅਦ ਉਹਨੂੰ ਵਧੀਆ ਰੁਜ਼ਗਾਰ ਦੇ ਮੌਕਿਆ ਲਈ ਪੂਰੇ ਭਾਰਤ ਜਾਂ ਭਾਰਤ ਤੋਂ ਬਾਹਰ ਲਿਜਾ ਕੇ ਉਸ ਨੂੰ ਮੌਕੇ ਪ੍ਰਦਾਨ ਕਰਵਾ ਸਕੇ ਇਹ ਵੀ ਇੱਕ ਮੁੱਖ ਚੁਣੌਤੀ ਸਾਹਮਣੇ ਬਣ ਕੇ ਆਉਂਦੀ ਆ ਦੂਸਰਾ ਕੀ ਹੈ ਮਚੋਰਟੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਉਹ ਇੰਨਾ ਕੁ ਜ਼ਿਆਦਾ ਸੋਚਣ ਲੱਗ ਗਏ ਨੇ ਕਿ ਅਸੀਂ ਇਹ ਵੀ ਕਰ ਲਈਏ ਉਹ ਵੀ ਕਰ ਲਈਏ ਫਾਇਦੇ ਸੋਚਣ ਲੱਗ ਗਏ ਹਨ ਰੁਜ਼ਗਾਰ ਨੂੰ ਲੈ ਕੇ ਤਾਂ ਉਹਦੇ ਨਾਲ ਉਹਨਾਂ ਦੇ ਵਿੱਚ ਜਿਹੜੀ ਗੁੰਝਲਤਾ ਦਿਨ ਬ ਦਿਨ ਵੱਧਦੀ ਜਾਂਦੀ ਹੈ ਅਤੇ ਇਹਦੇ ਨਾਲ ਉਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਅੰਡਰ ਪ੍ਰੈਸ਼ਰ ਵੀ ਸੋਚਦੇ ਨੇ ਅਤੇ ਥੋੜ੍ਹਾ ਉਹਨਾਂ ਦਾ ਮੈਂਟਲ ਪੀਸ ਵੀ ਹੈ ਜਿਹੜਾ ਉਹ ਭੰਗ ਹੋ ਰਿਹਾ ਹੈਗਾ ਇਹ ਮੁੱਖ ਚੁਣੌਤੀਆਂ ਨੇ ਜਿਹੜੀਆਂ ਸਿੱਖਿਆ ਰੁਜ਼ਗਾਰ 'ਤੇ ਐਵੇਂ ਹੀ ਲੀਡਰਸ਼ਿਪ ਦੇ ਵਿੱਚ ਆ ਰਹੀਆਂ ਨੇ ਪਟਿਆਲੇ ਜ਼ਿਲ੍ਹੇ ਦੇ ਨੌਜਵਾਨਾਂ ਦੇ ਵਿੱਚ ਲੀਡਰਸ਼ਿਪ ਜੇ ਕੋਈ ਵਧੀਆ ਕੰਪਨੀ ਹੈਗੀ ਹੈ ਤਾਂ ਤਾਂ ਉਹ ਉਹਨਾਂ ਨੂੰ ਮਤਲਬ ਲੀਡਰਸ਼ਿਪ ਦੇ ਉਹਨਾਂ ਦੇ ਵਿੱਚ ਗੁਣ ਆ ਸਕਦੇ ਨੇ ਪਰ ਜੇ ਕਿਸੇ ਕੰਪਨੀ ਦੇ ਵਿੱਚ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਤਾਂ ਉਹਦੇ ਵਿੱਚ ਉਹ ਲੀਡਰਸ਼ਿਪ ਨਹੀਂ ਆਊਗੀ ਨਾ ਹੀ ਪੋਲੀਟਿਕਸ ਦੇ ਵਿੱਚ ਇੰਨੇ ਵਧੀਆ ਮੌਕੇ ਮਿਲਦੇ ਨੇ ਤਾਂ ਕਰਕੇ ਕੁਛ ਕੁ ਚੁਣੌਤੀਆਂ ਆ ਰਹੀਆਂ ਨੇ ਦੂਸਰੀ ਗੱਲ ਹੈਗੀ ਆ ਮੌਕੇ ਮੌਕੇ ਜੇ ਸਿੱਖਿਆ ਦੀ ਗੱਲ ਕਰੀਏ ਯੂਨੀਵਰਸਿਟੀਆਂ ਜਿਵੇਂ ਪੰਜਾਬੀ ਯੂਨੀਵਰਸਿਟੀ ਹੋ ਗਈ ਪਟਿਆਲਾ ਦੇ ਵਿੱਚ ਬਹੁਤ ਵਧੀਆ ਮੌਕੇ ਦੇ ਰਹੀ ਹੈ ਬੱਚਿਆਂ ਨੂੰ ਉਚੇਰੀ ਵਿੱਦਿਆ ਪ੍ਰਾਪਤੀ ਦੇ ਲਈ ਉਹਨਾਂ ਨੂੰ ਕਿਤੇ ਦੂਰ ਨਹੀਂ ਜਾਣਾ ਪੈਂਦਾ ਜੇ ਕਿਤੇ ਬੱਚੇ ਮਤਲਬ ਪੇਰੈਂਟਸ ਨਹੀਂ ਭੇਜ ਸਕਦੇ ਬਾਹਰ ਪਟਿਆਲੇ ਦੇ ਵਿੱਚ ਰਹਿ ਕੇ ਉਹ ਉਚੇਰੀ ਵਿੱਦਿਆ ਦੀ ਪ੍ਰਾਪਤੀ ਕਰ ਸਕਦੇ ਹਨ ਬਹੁਤ ਵਧੀਆ ਕੋਲਜ ਨੇ ਲੋਅ ਦਾ ਕੋਲਜ ਹੈਗਾ ਕਮਰਸ ਕੋਲਜ ਹੈਗਾ ਉੱਥੋਂ ਉਹ ਇੱਕ ਥਾਪਰ ਯੂਨੀਵਰਸਿਟੀ ਬਹੁਤ ਵਧੀਆ ਹੈਗੀ ਆ ਉੱਥੋਂ ਆਪਣੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ ਪਰ ਜੇ ਰੁਜ਼ਗਾਰ ਦੀ ਗੱਲ ਕਰੀਏ ਤਾਂ ਸਰਕਾਰ ਰੋਜ਼ਗਾਰ ਦੇ ਮੌਕੇ ਇੰਨੇ ਪ੍ਰਦਾਨ ਕਰ ਹੀ ਨਹੀਂ ਰਹੀ ਹੈਗੀ ਉਹ ਇੰਨੀਆਂ ਪੋਸਟਾਂ ਕੱਢ ਹੀ ਨਹੀਂ ਰਹੇ ਹੈਗੇ ਜਦੋਂ ਤੱਕ ਬੱਚੇ ਦੀ ਸਟੱਡੀ ਕੰਪਲੀਟ ਹੁੰਦੀ ਹੈ ਜਦੋਂ ਉਹ ਇੱਕ ਸੋਚਦਾ ਹੈ ਕਿ ਮੈਂ ਇੱਕ ਵਧੀਆ ਰੁਜ਼ਗਾਰ ਪ੍ਰਾਪਤ ਕਰ ਲਵਾਂ ਵਧੀਆ ਨੌਕਰੀ ਤੱਕ ਚਲਾ ਜਾਵਾਂ ਪਰ ਐਟ ਦਾ ਐਂਡ ਕੀ ਹੁੰਦਾ ਉਹਨੂੰ ਉ ਉਸ ਸਮੇਂ ਪੋਸਟਾਂ ਨਹੀਂ ਨਿਕਲਦੀਆਂ ਅਤੇ ਐਵੇਂ ਹੀ ਉਹਦੀ ਉਮਰ ਵੱਧਦੀ ਜਾਂਦੀ ਆ ਅਤੇ ਵੱਧਦੀ ਉਮਰ ਦੇ ਨਾਲ ਉਹ ਜਦੋਂ ਤੱਕ ਪੋਸਟਾਂ ਨਿਕਲਦੀਆਂ ਨੇ ਤਾਂ ਉਹ ਉਹਨਾਂ ਪੋਸਟਾਂ ਦੇ ਵਿੱਚ ਅਪਲਾਈ ਨਹੀਂ ਕਰ ਸਕਦਾ ਇਸ ਤਰ੍ਹਾਂ ਬੇਰੁਜ਼ਗਾਰੀ ਦੇ ਵੱਲ ਧੱਕਿਆ ਜਾਂਦਾ ਹੈ ਇਹ ਥੋੜ੍ਹੇ ਜਿਹੇ ਜਿਹੜੇ ਮੌਕੇ ਨੇ ਰੁਜ਼ਗਾਰ ਦੇ ਪ੍ਰਤੀ ਨੌਜਵਾਨਾਂ ਨੂੰ ਘੱਟ ਮਿਲ ਰਹੇ ਨੇ